ਸਮੇਂ ਦੇ ਨਾਲ ਨਾਲ ਪੰਜਾਬੀ ਭਾਸ਼ਾ ਬਹੁਤ ਜ਼ਿਆਦਾ ਵਿਕਸਿਤ ਹੋਈ ਹੈ ਕਿਉਂਕਿ ਸਾਡੀ ਮਾਂ ਬੋਲੀ ਹੀ ਪੰਜਾਬੀ ਹੈ ਜਿਵੇਂ ਅੱਜ ਕੱਲ੍ਹ ਪੰਜਾਬੀ ਦੁਨੀਆ ਦੇ ਵੱਖ ਵੱਖ ਕੋਨਿਆਂ ਵਿੱਚ ਜਾ ਕੇ ਰਹਿ ਰਹੇ ਹਨ ਜੋ ਕਿ ਸਾਡੀ ਪੰਜਾਬੀ ਭਾਸ਼ਾ ਲਈ ਬ ਵਿਕਾਸ ਵਿੱਚ ਜੋ ਬਹੁਤ ਜ਼ਿਆਦਾ ਮਹੱਤਵਪੂਰਨ ਉਹਨਾਂ ਨੇ ਕਾਰਜ ਨਿਭਾਇਆ ਹੈ ਜਿਸ ਨਾਲ ਸਾਡੀ ਮਾਂ ਬੋਲੀ ਪੰਜਾਬੀ ਬਹੁਤ ਜ਼ਿਆਦਾ ਵਿਕਸਿਤ ਹੋਈ ਹੈ ਪਰ ਦਿਨੋ ਦਿਨ ਇਸ 'ਚ ਬਹੁਤ ਜ਼ਿਆਦਾ ਤਬਦੀਲੀਆਂ ਆ ਰਹੀਆਂ ਹਨ ਕਿਉਂਕਿ ਕਈ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਸਿਖਾਇਆ ਨਹੀਂ ਜਾ ਰਿਹਾ ਅਤੇ ਹੁਣ ਪੰਜਾਬ ਦੇ ਜਵਾਕ ਆਪਣੀ ਮਾਂ ਬੋਲੀ ਤੋਂ ਕਿਤੇ ਨਾ ਕਿਤੇ ਵਿਛੜਦੇ ਜਾ ਰਹੇ ਹਨ ਪਰ ਹੌਲੀ ਹੌਲੀ ਪੰਜਾਬੀ ਭਾਸ਼ਾ ਦੇ ਵਿਕਾਸ ਬਹੁਤ ਹੋਇਆ ਹੈ ਹੌਲੀ ਹੌਲੀ ਤਬਦੀਲੀਆਂ ਵੀ ਇਸ 'ਚ ਆਈਆਂ ਹਨ ਸਮੇਂ ਦੇ ਬਦਲਾਅ ਨਾਲ ਜੋ ਕਿ ਕਿਤੇ ਨੇ ਕੀਤੇ ਸਹੀ ਵੀ ਹਨ ਅਤੇ ਗਲਤ ਵੀ